ਹਾਂਜੀ ਮੈਨੂੰ ਲੱਗਦਾ ਆ ਕਿ ਇਹ ਮੀਡੀਆ ਵਾਲੇ ਜਿਹੜੇ ਪਿੰਡਾਂ ਵਿੱਚ ਜਾਂ ਉਹ ਅਖਬਾਰ ਵਿੱਚ ਘੱਟ ਦੱਸਦੇ ਆ ਸ਼ਹਿਰ ਦਾ ਜ਼ਿਆਦਾ ਦੱਸਦੇ ਆ ਪਿੰਡਾਂ ਵਿੱਚ ਜਿੱਦਾਂ ਹੁਣ ਗਲੀਆਂ ਗੁਲੀਆਂ ਟੁੱਟੀਆਂ ਹੁੰਦੀਆਂ ਆ ਕੋਈ ਨਾ ਕੋਈ ਪਾਣੀ ਦੀ ਸਮੱਸਿਆ ਖੇਤਾਂ ਵਿੱਚ ਜਿੱਦਾਂ ਹੁਣ ਪਾਣੀ ਪੂਣੀ ਦਾ ਵੀ ਹੁੰਦਾ ਜ਼ਿਆਦਾ ਇਹ ਵੀ ਨਹੀਂ ਦੱਸਦੇ ਹੈਗੇ ਚੰਗੀ ਤਰ੍ਹਾਂ ਤਾਂ ਉਹ ਬਾਕੀ ਖਬਰਾਂ ਵੀ ਚੰਗੀ ਤਰ੍ਹਾਂ ਦੱਸਦੇ ਨਹੀਂ ਆ ਪਿੰਡ ਵਾਲੇ ਤਾਂ ਉਹ ਮੀਡੀਆ ਵਾਲੇ ਸਧਾਰਨ ਦੱਸਦੇ ਨਹੀਂ ਉਹ ਕੋਈ ਜਿੱਦਾਂ ਹੁਣ ਆਹ ਨਸ਼ੇ ਨੁਸ਼ਿਆ ਵੇਚਣ ਵਾਲੇ ਇਹ ਵੀ ਨਹੀਂ ਜ਼ਿਆਦਾ ਚੰਗੀ ਤਰ੍ਹਾਂ ਉਹ ਦੱਸਦੇ ਕੋਈ ਕਰਦੇ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਬੰਦ ਬੁੰਦ ਪੜ੍ਹਾਈ ਬਾਰੇ ਬਾਕੀ ਬੱਚਿਆਂ ਬਾਰੇ ਪਿੰਡਾਂ ਦੇ ਵਿੱਚ ਕੋਈ ਸੋਚਦੇ ਨਹੀਂ ਆ ਖੇਤਾਂ ਖੁਤਾਂ ਬਾਰੇ ਹਾਂਜੀ ਜਿਹੜੇ ਹੁੰਦੇ ਇਹ ਵੀ ਨਹੀਂ ਕੁਛ ਦੇਖਦੇ ਸੋਚਦੇ ਹੈਗੇ ਬਹੁਤ ਘੱਟ ਉਹ ਛਾਪਦੇ ਆ ਸ਼ਹਿਰਾਂ ਸ਼ੁਰਾਂ ਦੀਆਂ ਜ਼ਿਆਦਾ ਖਬਰਾਂ ਆਉਂਦੀਆਂ ਆ ਤਾਂ ਹੋਰ ਬਾਕੀ ਸਬਕ ਦਾ ਦੂਜਾ ਬਹੁਤ ਬਹੁਤ ਤੁਹਾਡਾ ਧੰਨਵਾਦ